ਸਤਿ ਸ਼੍ਰੀ ਅਕਾਲ ਜੀ ਪੰਜਾਬ ਜਿਹੜਾ ਹੈ ਇੱਕ ਲੋਕਤੰਤਰ ਦੇਸ਼ ਹੈ ਇਸ ਲੋਕਤੰਤਰ ਦੇਸ਼ ਵਿੱਚ ਵੱਖ ਵੱਖ ਧਰਮਾਂ ਜਾਤਾਂ ਦੇ ਲੋਕ ਰਹਿੰਦੇ ਹਨ ਅਤੇ ਹਰ ਇੱਕ ਧਰਮ ਜਾਤ ਦੇ ਲੋਕ ਨੂੰ ਬਰਾਬਰ ਦਾ ਹੱਕ ਹੈ ਬੋਲਣ ਦਾ ਆਪਣੀਆਂ ਗੱਲਾਂ ਦਾ ਸਰਕਾਰ ਅੱਗੇ ਰੱਖਣ ਦਾ ਜਿਵੇਂ ਬੇਰੁਜ਼ਗਾਰੀ ਇੱਕ ਬਹੁਤ ਹੀ ਵ ਵੱਡਾ ਮੁੱਦਾ ਹੈ ਇਸ ਬਾਰੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਨਾ ਕਿ ਉਹਨਾਂ ਨੂੰ ਦੱਬਣਾ ਚਾਹੀਦਾ ਹੈ ਉਹ ਬੇਰੁਜ਼ਗਾਰੀ ਨੂੰ ਖਤਮ ਕਰਨ ਦੇ ਤਰੀਕੇ ਲੱਭਣੇ ਚਾਹੀਦੇ ਆ ਦੂਜਾ ਸਾਡੇ ਦੇਸ਼ ਵਿੱਚ ਬਹੁਤ ਹੀ ਜ਼ਿਆਦਾ ਨਸ਼ੇ ਦਾ ਕੇਂਦਰ ਬਣ ਚੁੱਕਿਆ ਹੈ

ਜ਼ੰਜੀਰਾਂ ਵਿੱਚ ਨਾ ਫਸਣ ਹੋਰ ਸਾਨੂੰ ਆਪਣੇ ਦੇਸ਼ ਦੇ ਵਿਕਾਸ ਦਰ ਲਈ ਸੋਚਣਾ ਚਾਹੀਦਾ ਹੈ ਅਸੀਂ ਅੱਜ ਦੇਸ਼ ਸਾਡਾ ਵਰਲਡ ਬੈਂਕ ਦਾ ਕਰਜ਼ਾਈ ਹੈ ਅਸੀਂ ਉਸ ਪਾਸੇ ਨਾ ਧਿਆਨ ਕਰਕੇ ਆਪਣੀ ਜੀ ਡੀ ਪ ਵੱਲ ਨਾ ਧਿਆਨ ਕਰਕੇ ਧਾਰਮਿਕ ਪਾਸਿਆਂ ਵੱਲ ਜ਼ਿਆਦਾ ਉਲਝੇ ਹੋਏ ਹਨ ਇਹਨਾਂ ਨੂੰ ਸਾਨੂੰ ਖਤਮ ਕਰਨਾ ਚਾਹੀਦਾ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਇਹ ਚੀਜ਼ਾਂ ਨੂੰ ਖਤਮ ਕਰੇ ਅਤੇ ਉਹ ਸਿਰਫ ਆਪਣੀ ਦੇਸ਼ ਦੀ ਤਰੱਕੀ ਦੇ ਵਿਕਾਸ ਬਾਰੇ ਸੋਚੇ ਤਾਂ ਜੋ ਆਉਣ ਵਾਲੇ ਸਮੇਂ 'ਚ ਅਸੀਂ ਹੀ ਇਹ ਨਾ ਹੋਏ ਕਿ ਹੋਰ ਹੀ ਵੋਰਡ ਬੈਂਕ ਦੇ ਕਰਜ਼ਾਈ ਨਾ ਬਣ ਸਕੀਏ ਅਤੇ ਤਰੱਕੀ ਕਰਨ ਵੱਲ ਧਿਆਨ ਕਰੀਏ ਇਹ ਸਾਨੂੰ ਖਾਸ ਕਰਕੇ ਆਪਣੇ ਦੇਸ਼ ਦੀ ਧਾਰਮਿਕ ਭਾਵਨਾਵਾਂ ਨੂੰ ਇਹ ਇਸ ਮਸਲਿਆਂ ਵਿੱਚ ਦੇਸ਼ ਦੀ ਤਰੱਕੀ ਦੇ ਮਸਲਿਆਂ ਵਿੱਚ ਨਹੀਂ ਉਲਝਾਉਣਾ ਚਾਹੀਦਾ ਲੋਕਾਂ ਨੂੰ ਸੋ ਇਹ ਸਭ ਤੋਂ ਹੀ ਗਲਤ ਗੱਲ ਹੈ ਜੋ ਓ ਸਾਡਾ ਦੇਸ਼ ਇਹਨਾਂ ਚੀਜ਼ਾਂ 'ਚ ਉਲਝ ਰਿਹਾ ਹੈ ਹਰ ਇੱਕ ਚੀਜ਼ ਦਾ ਹੱਲ ਬੈਠ ਕੇ ਬਹੁਤ ਹੀ ਅਰਾਮਦਾਇਕ ਹੋ ਸਕਦਾ ਹੈ ਮਸਲਿਆਂ ਦਾ ਹੱਲ ਹੋ ਸਕਦਾ ਹੈ ਕਿਸੇ ਵੀ ਕਿਸਾਨੀ ਅੰਦੋਲਨ ਨੂੰ ਕੁਛ ਵੀ ਅੰਦੋਲਨ ਹੈ ਸਾਡੀਆਂ ਖਬਰਾਂ ਜੋ ਬਾਹਰ ਲੀਕ ਹੁੰਦੀਆਂ ਸਾਡੇ ਦੇਸ਼ ਦਾ ਉਹ ਬਹੁਤ ਹੀ ਬੁਰਾ ਅਸਰ ਪੈਂਦਾ ਹੈ ਇਹ ਇਹ ਸਭ ਖਤਮ ਕਰਕੇ ਸਾਨੂੰ ਇਹਨੂੰ ਆਪਣੇ ਘਰ ਵਿੱਚ ਹੀ ਨਜਿੱਠ ਲੈਣਾ ਚਾਹੀਦਾ ਹੈ ਤਾਂ ਜੋ ਬਾਹਰਲੇ ਹਕੂਮਤਾਂ ਨੂੰ ਸਾਡੇ ਬਾਰੇ ਕੋਈ ਇਨਫੋਰਮੇਸ਼ਨ ਪਤਾ ਨਾ ਚੱਲ ਸਕੇ ਸੋ ਮੈਂ ਤਾਂ ਇਹ ਦੱਬੇ ਹੋਏ ਮਸਲੇ ਜਿਹੜੇ ਆ ਉਲਝ ਉਲਝ ਕੇ ਬਾਹਰ ਜਾ ਰਹੇ ਹਨ ਇਹ ਚੰਗੀ ਗੱਲ ਨਹੀਂ ਹੈ ਇਹਨਾਂ ਨੂੰ ਇੱਥੇ ਹੀ ਖਤਮ ਕਰ ਦੇਣਾ ਚਾਹੀਦਾ ਹੈ